ਮੈਂ ਜਲੰਧਰ ਦੇ ਇੱਕ ਕਿਤਾਬ ਮੇਲੇ ਵਿੱਚ ਗਈ ਸੀ ਅਤੇ ਉੱਥੇ ਮੈਂ ਸ਼ਿਵ ਕੁਮਾਰ ਬਟਾਲਵੀ ਦੀ ਜਿਹੜੀ ਕਲਾਸਿਕ ਕਿਤਾਬ ਹੈ ਲੂਣਾ ਉਹ ਦੇਖੀ ਇਹ ਮੇਰੀ ਬਹੁਤ ਮਨਪਸੰਦ ਜਿਹੜੇ ਸ਼ਿਵ ਕੁਮਾਰ ਬਟਾਲਵੀ ਹੈ ਇਹ ਮੇਰਾ ਇੱਕ ਮਨਪਸੰਦ ਕਵੀ ਹੈ ਠੀਕ ਹੈ ਅਤੇ ਇੱਥੇ ਜਿਹੜੀਆਂ ਇਹ ਕਿਤਾਬਾਂ ਸੀਗੀਆਂ ਇਹ ਡਿਸਕਾਊਂਟ 'ਤੇ ਮਿਲ ਰਹੀਆਂ ਸੀਗੀਆਂ ਅਤੇ ਫਿਰ ਉੱਥੋ ਮੈਂ ਪੈ ਵੈਸੇ ਤਾਂ ਇਹਦਾ ਜਿਹੜਾ ਰੇਟ ਹੈ ਦੋ ਸੌ ਰੁਪਏ ਲ ਸੀਗਾ ਪਰ ਪਰ ਮੈਨੂੰ ਇਹ ਇੱਕ ਸੌ ਵੀਹ ਰੁਪਏ ਦੀ ਡਿਸਕਾਊਂਟ 'ਤੇ ਮਿਲ ਰਹੀ ਸੀਗੀ ਅਤੇ ਮੈਂ ਫਿਰ ਇਸ ਨੂੰ ਖਰੀਦ ਲਿਆ